ਨਿਊਜ਼ ਮੀਡੀਆ ਆਪਣੀ ਰਿਪੋਰਟਿੰਗ ਵਿੱਚ ਵਿਸ਼ਵਾਸ ਦੇ ਭਰੋਸੇ ਯੋਗਤਾ ਸਿਧ ਸਿੱਧੀ ਲੋਕਾਂ ਨਾਲ ਰੂਬਰੂ ਹੋ ਕੇ ਕਰ ਸਕਦਾ ਹੈ ਜਿੱਥੇ ਜਿੱਥੇ ਬਿਨਾਂ ਬੋਲੇ ਹਰ ਕੋਈ ਆਪਣੀ ਗੱਲ ਕਹਿ ਸਕਦਾ ਹੈ ਤੇ ਲੋਕਾਂ ਨੂੰ ਜਾਨੂ ਬਣਾ ਸਕਦਾ ਹੈ ਦੁਨੀਆ ਭਰ ਦੀਆਂ ਖਬਰਾਂ ਸਭ ਨੂੰ ਰੂਬਰੂ ਕਰ ਸਕਦਾ ਹੈ ਨਿਊਜ਼ ਮੀਡੀਆ ਨੂੰ ਆਪਣੇ ਬਹੁਤ ਅੱਛੀ ਤਰਾਂ ਫੈਦੇ ਹਨ